ਸਰਕਾਰੀ ਸਕੀਮਾਂ ਅਧੀਨ ਦਿੱਤੀਆਂ ਜਾਣ ਵਾਲੀਆਂ ਸਿਹਤ ਸੇਵਾਵਾਂ ਦੀ ਗੁਣਵੱਤਾ ਬਹੁਤ ਵਧੀਆ ਹੈ ਇਸ ਨਾਲ ਆਮ ਨਾਗਰਿਕ ਨੂੰ ਬਹੁਤ ਜ਼ਿਆਦਾ ਮਦਦ ਮਿਲ ਰਹੀ ਹੈ ਕਿਉਂਕਿ ਅੱਜ ਕੱਲ੍ਹ ਇਲਾਜ ਕਰਾਉਣਾ ਕੋਈ ਅੱਜ ਕੱਲ੍ਹ ਇਲਾਜ ਕਰਾਉਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਕਿਉਂਕਿ ਇਲਾਜ ਅੱਜ ਕੱਲ੍ਹ ਜਿਹੜੇ ਇਲਾਜ ਨੇ ਉਹ ਬਹੁਤ ਜ਼ਿਆਦਾ ਮਹਿੰਗੇ ਹੋ ਚੁੱਕੇ ਨੇ ਇਸ ਲਈ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਸਰਕਾਰੀ ਸਕੀਮਾਂ ਦਾ ਲਾਭ ਉਠਾਉਣਾ ਚਾਹੀਦਾ ਹੈ ਬਹੁਤ ਸਾਰੀਆਂ ਸਰਕਾਰ ਜਿਹੜੀਆਂ ਬਹੁਤ ਸਾਰੀਆਂ ਸਕੀਮਾਂ ਲੈ ਕੇ ਆ ਰਹੀ ਆ ਜਿਵੇਂ ਆਯੁਸ਼ਮਾਨ ਕਾਰਡ ਇਹਦੇ ਵਿਚ ਸਾਨੂੰ ਪੰਜ ਲੱਖ ਰੁਪਏ ਤੱਕ ਦਾ ਇਲਾਜ ਇਲਾਜ ਫਰੀ ਮਿਲਦਾ ਹੈ ਜੇ ਆਪਾਂ ਕੋਈ ਵੀ ਆਪਣਾ ਦੁਰਘਟਨਾ ਵਾਪਰ ਜਾਂਦੀ ਹੈ ਤਾਂ ਆਯੁਸ਼ਮਾਨ ਕਾਰਡ ਦੀ ਸਹਾਇਤਾ ਨਾਲ ਅਸੀਂ ਆਪਣਾ ਫਰੀ ਵਿੱਚ ਇਲਾਜ ਕਰਵਾ ਸਕਦੇ ਹਾਂ ਕਿਉਂਕਿ ਇਹਦੇ ਇਹਦੇ ਵਿੱਚ ਪੰਜ ਲੱਖ ਦਾ ਫਰੀ ਇਲਾਜ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਹੀ ਸਰਕਾਰੀ ਹਸਪਤਾਲ ਅਤੇ ਨਿੱਜੀ ਹਸਪਤਾਲ ਵਿੱਚ ਆਪਣੇ ਆਪਣੇ ਤਰੀਕੇ ਨਾਲ ਇਲਾਜ ਹੁੰਦਾ ਹੈ ਜਿਵੇਂ ਸਰਕਾਰੀ ਹਸਪਤਾਲਾਂ ਵਿੱਚ ਬਹੁਤ ਘੱਟ ਖਰਚਾ ਹੁੰਦਾ ਜਿਸ ਨਾਲ ਕੋਈ ਵੀ ਗਰੀਬ ਤੋਂ ਗਰੀਬ ਵਿਅਕਤੀ ਆਪਣਾ ਵਧੀਆ ਤੋਂ ਵਧੀਆ ਇਲਾਜ ਕਰਵਾ ਸਕਦਾ ਹੈ ਅਤੇ ਨਿਜੀ ਹਸਪਤਾਲਾਂ ਵਿੱਚ ਵੀ ਸਰਵਿਸ ਬਹੁਤ ਵਧੀਆ ਹੈਗੀ ਆ ਹਾਂ ਦਿਨੋ ਦਿਨ ਟੈਕਨੋਲਜੀ ਵਧ ਰਹੀ ਹੈ ਜਿਸ ਨਾਲ ਨਿੱਜੀ ਹਸਪਤਾਲ ਅਤੇ ਸਰਕਾਰੀ ਹਸਪਤਾਲ ਦੋਨਾਂ ਵਿੱਚ ਹੀ ਮਰੀਜ਼ਾਂ ਦਾ ਇਲਾਜ ਬਹੁਤ ਧਿਆਨ ਨਾਲ ਕੀਤਾ ਜਾਂਦਾ ਹੈ ਸਰਕਾਰੀ ਹਸਪਤਾਲਾਂ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਅੰਤਰ ਇਹ ਕਿ ਸਰਕਾਰੀ ਹਸਪਤਾਲਾਂ ਵਿੱਚ ਸਾਨੂੰ ਫਰੀ ਅਸੀਂ ਫਰੀ ਵਿੱਚ ਇਲਾਜ ਕਰਵਾ ਸਕਦੇ ਹਾਂ ਬਹੁਤ ਘੱਟ ਖਰਚੇ ਵਿੱਚ ਅਤੇ ਪ੍ਰਾਈਵੇਟ ਪ੍ਰਾਈਵੇਟ ਹਸਪਤਾਲਾਂ ਵਿੱਚ ਮਰੀਜ਼ ਦੇਖਭਾਲ ਬਹੁਤ ਚੰਗੇ ਤਰੀਕੇ ਨਾਲ ਕੀਤੀ ਜਾਂਦੀ ਹੈ ਅਤੇ ਉਹਨੂੰ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਵੀ ਇਲਾਜ ਜਿਹੜਾ ਉਹ ਕੀਤਾ ਜਾਂਦਾ ਸੀ ਨਵੀਆਂ ਨਵੀਆਂ ਖੋਜਾਂ ਹੋ ਰਹੀਆਂ ਨੇ ਅਤੇ ਨਵੀਆਂ ਨਵੀਆਂ ਨਵੀਆਂ ਨਵੀਆਂ ਨਵੀਆਂ ਨਵੀਆਂ ਨਵੇਂ ਨਵੀਆਂ ਨਵੀਆਂ ਮੈਡੀਸਨ ਇਨਵੈਂਟ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਵੱਧ ਤੋਂ ਵੱਧ ਜਿਹੜੇ ਲੋਕ ਆ ਉਹ ਸਵੱਸਥ ਰਹਿ ਸਕਣ